ਕਿਤਾਬਾਂ ਪੜ੍ਹਨਾ ਵੀ ਮੇਰਾ ਇੱਕ ਸ਼ੌਂਕ ਹੈ ਮੇਰੀ ਇੱਕ ਆਦਤ ਹੈ ਪਰ ਕਿਤਾਬਾਂ ਤੋਂ ਬਿਨਾਂ ਮੈਂ ਹੋਰ ਬਹੁਤ ਸਾਰੇ ਅਖਬਾਰ ਵੀ ਪਸੰਦ ਕਰਦਾ ਜਿਵੇਂ ਜੱਗ ਬਾਣੀ ਅਜੀਤ ਤਾਂ ਅੱਜ ਦੀ ਆਵਾਜ਼ ਇਸ ਤੋਂ ਬਿਨਾਂ ਪੰਜਾਬੀ ਟ੍ਰਿਬਿਊਨ ਬਹੁਤ ਮਨ ਭਾਉਂਦਾ ਅਖਬਾਰ ਹੈ ਮੇਰਾ ਤਾਂ ਉਹ ਬਹੁਤ ਸਾਰੇ ਅਖਬਾਰ ਮੈਂ ਪੜ੍ਹਦਾ ਕਿਉਂਕਿ ਅਖਬਾਰਾਂ ਦੇ ਰਾਹੀਂ ਸਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਵਾਪਰਦਾ ਹੈਗਾ ਜੋ ਖਬਰਾਂ ਆਰਟੀਕਲ ਬਹੁਤ ਸਾਰੇ ਜਿਹੜੀ ਵਧੀਆ ਜਾਣਕਾਰੀ ਸਾਨੂੰ ਮਿਲਦੀ ਹੈ ਬਹੁਤ ਸਾਰੇ ਅੱਛੇ ਲੇਖਕ ਜਿਹੜੇ ਉਹ ਆਪਣੇ ਮਤਲਬ ਜਿਹੜੇ ਆ ਉਹਦੇ 'ਚ ਲੇਖ ਲਿਖਦੇ ਹੈ ਅੱਡ ਅੱਡ ਵਿਸ਼ਿਆਂ ਦੇ ਉੱਤੇ ਸਾਨੂੰ ਪੰਜ ਹਿੰਦੁਸਤਾਨ ਦੀ ਭਾਰਤ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਉਹ ਪਤਾ ਲੱਗਦਾ ਸਾਡੇ ਸਟੇਟ ਦੀ ਪੰਜਾਬ ਦੀ ਰਾਜ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਹੈ ਇਹ ਪਤਾ ਲੱਗਦਾ ਤਾਂ ਇਸ ਤਰ੍ਹਾਂ ਅਖਬਾਰ ਪੜ੍ਹਨ ਦਾ ਇਹ ਬੈਨੀਫਿਟ ਹੁੰਦਾ ਹੈਗਾ ਇਹ ਫਾਇਦਾ ਹੁੰਦਾ ਹੈਗਾ ਕਿਤਾਬਾਂ ਦਾ ਇੱਕ ਅਲੱਗ ਫਾਇਦਾ ਹੈਗਾ ਅਤੇ ਅਖਬਾਰਾਂ ਦਾ ਇੱਕ ਅਲੱਗ ਫਾਇਦਾ ਹੈਗਾ ਅਤੇ ਇਸੇ ਕਰਕੇ ਮੈਂ ਕਿਤਾਬਾਂ ਤੋਂ ਬਿਨਾਂ ਜਿਹੜੇ ਹੋਰ ਬਹੁਤ ਸਾਰੇ ਅਖਬਾਰ ਵੀ ਪੜ੍ਹਦਾ ਜਿਹਦੇ ਨਾਲ ਮੇਰੀ ਜਾਣਕਾਰੀ 'ਚ ਵਾਧਾ ਹੁੰਦਾ ਮੇਰੇ ਗਿਆਨ 'ਚ ਵਾਧਾ ਹੁੰਦਾ ਅਤੇ ਮੈਨੂੰ ਲੋਕਾਂ ਨਾਲ ਗੱਲਬਾਤ ਕਰਨ 'ਚ ਲੋਕਾਂ ਨਾਲ ਡਿਸਕਸ਼ਨ ਕਰਨ ਦੇ ਵਿੱਚ ਜਿਹੜੀ ਹੈ ਸ ਫਾਇਦਾ ਹੁੰਦਾ ਸਹੂਲਤ ਮਿਲਦੀ ਹੈਗੀ